ਅਸੀਂ ਆਪਣੇ ਜ਼ਿਲ੍ਹੇ ਬਾਰੇ ਬਹੁਤ ਕੁਛ ਜਾਣਦੇ ਹਾਂ ਜਿਸ ਤਰ੍ਹਾਂ ਕਿ ਬਹੁਤ ਇੱਥੇ ਬਹੁਤ ਹੀ ਇਤਿਹਾਸਿਕ ਸਥਾਨ ਹਨ ਜਿਸ ਤਰ੍ਹਾਂ ਕਿ ਅਨੰਦਪੁਰ ਸਾਹਿਬ ਜਿੱਥੇ ਕਿ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਅਤੇ ਵਿਸਾਖੀ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ ਇੱਥੇ ਬਹੁਤ ਹੀ ਖੂਬ ਸੰ ਸੰਗਤਾਂ ਦਾ ਮੇਲਾ ਲੱਗ ਮ ਜੋੜ ਮੇਲਾ ਲੱਗਦਾ ਹੈ ਅਤੇ ਇੱਥੇ ਚਮਕੌਰ ਸਾਹਿਬ ਜਿੱਥੇ ਜਿੱਥੇ ਕਿ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਉੱਥੇ ਵੀ ਬਹੁਤ ਜੋੜ ਮੇਲਾ ਲੱਗਦਾ ਹੈ ਅਤੇ ਗੁਰਦੁਆਰਾ ਸਾਹਿਬ ਵਿਛੋੜਾ ਸਾਹਿਬ ਵੀ ਹੈ ਜਿੱਥੇ ਕਿ ਗੁਰੂ ਜੀ ਦੇ ਪਰਿਵਾਰ ਵਿਛੋੜਾ ਪਿਆ ਸੀ ਉਸ ਨੂੰ ਵਿਛੋੜਾ ਸਾਹਿਬ ਕਹਿੰਦੇ ਹਨ ਅਤੇ ਉੱਥੇ ਬਹੁਤ ਹੀ ਜੋੜ ਮੇਲਾ ਉੱਥੇ ਬਹੁਤ ਲੱਗਦਾ ਹੈ ਅਤੇ ਮਾਛੀਵਾੜਾ ਸਾਹਿਬ ਗੁਰਦੁਆਰਾ ਸਾਹਿਬ ਹੈ ਜਿੱਥੇ ਕਿ ਗੁਰੂ ਜੀ ਨੇ ਟਿਨੇ ਦਾ ਸਿਰ੍ਹਾਣਾ ਲਾਇਆ ਅਤੇ ਆਰਾਮ ਕੀਤਾ ਅਤੇ ਭੱਠਾ ਸਾਹਿਬ ਗੁਰਦੁਆਰਾ ਸਾਹਿਬ ਹੈ ਜਿੱਥੇ ਕਿ ਗੁਰੂ ਜੀ ਨੇ ਗੁਰੂ ਜੀ ਦੇ ਚਰਨ ਪਏ ਅਤੇ ਸੰਗਤਾਂ ਬਹੁਤ ਹੀ ਬਹੁਤ ਬਹੁ ਬਹੁਤ ਹੀ ਨਮਸਤਕ ਹੁੰਦੀਆਂ ਹਨ ਅਤੇ ਪਾਠ ਕਰਦੀਆਂ ਹਨ ਅਤੇ ਬਹੁਤ ਹੀ ਜ ਉੱਥੇ ਵੀ ਬਹੁਤ ਜੋੜ ਮੇਲਾ ਲੱਗਦਾ ਹੈ ਅਤੇ ਇੱਥੇ ਬਹੁਤ ਹੀ ਹੋਰ ਵੀ ਬਲਕਿ ਸੈਰ ਸਪਾਟੇ ਵਾਲੀਆਂ ਜਗ੍ਹਾ ਹਨ ਜਿਸ ਤਰ੍ਹਾਂ ਕਿ ਰੈਸਟੋਰੈਂਟ ਵੀ ਬਣੇ ਹੋਏ ਹਨ ਜਿਸ ਤਰ੍ਹਾਂ ਕਿ ਮਹਿਫਲੇ ਪੰਜਾਬ ਹਵੇਲੀ ਵੀ ਬਣੀ ਹੋਈ ਹੈ ਅਤੇ ਸਿੱਧੂ ਰੈਸਟੋਰੈਂਟ ਵੀ ਹੈ ਜਿੱਥੇ ਕਿ ਲੋਕ ਆਪਣੇ ਸੈਰ ਸਪਾਟੇ ਵਾਸਤੇ ਜਾਂਦੇ ਹਨ ਅਤੇ ਖਾਣ ਪੀਣ ਖਾ ਖਾਣ ਪੀਣ ਵਾਸਤੇ ਵੀ ਜਾਂਦੇ ਹਨ ਅਤੇ ਘੁੰਮਣ ਫਿਰਨ ਜਾਂਦੇ ਹਾਂ